ਮੈਨੂੰ ਬਾਈਕਿੰਗ ਦੀ ਸ਼ੁਰੂਆਤ ਲਈ ਪ੍ਰੇਰਨਾ ਦਾ ਸਰੋਤ ਮੇਰੇ ਪਿਤਾ ਜੀ ਅਤੇ ਮੇਰੇ ਭਰਾ ਹਨ ਜਿਹਨਾਂ ਨੂੰ ਦੇਖ ਕੇ ਮੈਂ ਬਾਈਕਿੰਗ ਦੀ ਸ਼ੁਰੂਆਤ ਕੀਤੀ ਸਨ ਕਿਉਂਕਿ ਮੈਨੂੰ ਆਪਣੇ ਜੀਵਨ ਵਿੱਚ ਇਸ ਸੈਗਮੈਂਟ ਨੂੰ ਨਵਜਾਨਾ ਦੇ ਰੂਪ ਵਿੱਚ ਦੇਖਿਆ ਸੀ ਅਤੇ ਇਸ ਦੇ ਰੋਮਾਂਟਿਕ ਸਵਾਲ ਵਿੱਚ ਖੁਦ ਨੂੰ ਖੋਜਣ ਦਾ ਖਿਆਲ ਕੀਤਾ ਬਾਈਕਿੰਗ ਨੇ ਮੇਰੇ ਜੀਵਨ ਵਿੱਚ ਬਹੁਤ ਤਬਦੀਲੀਆਂ ਕੀਤੀਆਂ ਹਨ ਬਾਈਕਿੰਗ ਨੂੰ ਮੇਰੇ ਜੀਵਨ ਨੂੰ ਇੱਕ ਨਵਾਂ ਚਾਅ ਅਤੇ ਮੁਕੰਮਲ ਅਨੁਭਵ ਦੀ ਤਰੀਕ ਨਾਲ ਭਰ ਦਿੱਤਾ ਹੈ ਇਸ ਦੌਰਾਨ ਮੈਂ ਮੈਂ ਆਪਣੇ ਹਰ ਇੱਕ ਤਰੀਕੇ ਦੇ ਨਾਲ ਬਹੁਤ ਹੀ ਸਾਵਧਾਨੀ ਅਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਪਣੀ ਜ਼ਿੰਦਗੀ ਵਿੱਚ ਜੀ ਰਿਹਾ ਹਾਂ ਇਸ ਦਿਨ ਨੇਚਰ ਅਤੇ ਹਰ ਹੰਡਲ ਅਤੇ ਪਵਿੱਤਰ ਸੁਨੇਹੇ ਨੂੰ ਸਾਂਝਾ ਕਰਨ ਦੀ ਅਨੁਭੂਤੀ ਮਿਲੀ ਜੋ ਮੇਰੀ ਸੂਖਮ ਦਿਲ ਨੂੰ ਛੂਹ ਦਿੱਤੀ ਹੈ ਸਾਲਾਂ ਦੌਰਾਨ ਮੈਨੂੰ ਬਾਈਕਿੰਗ ਨੇ ਇੱਕ ਸੰਤੁਲਨ ਵੀ ਦਿੱਤਾ ਹੈ ਆਪਣੀ ਜ਼ਿੰਦਗੀ ਵਿੱਚ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਅੱਗੇ ਜਾ ਰਿਹਾ ਹਾਂ ਮੈਨੂੰ ਬਾਈਕਿੰਗ ਨੂੰ ਸੰਤੁਲਨ ਦੇ ਰੂਪ ਵਿੱਚ ਇੱਕ ਮਹਿਸੂਸ ਕਰਾਉਣ ਦਾ ਸਵਾਦ ਹੋਇਆ ਹੈ ਜਿਸ ਤੋਂ ਮੇਰੇ ਜੀਵਨ ਵਿੱਚ ਆਉਣ ਜਾਣ ਦੇ ਤ ਤਜ਼ਰਬੇ ਹੋ ਰਹੇ ਹਨ ਬਾਈਕਿੰਗ ਨੇ ਮੇਰੇ ਆਤਮ ਵਿਸ਼ਵਾਸ ਅਤੇ ਸਹਾਇਤਾ ਦਾ ਅੰਗੂਰ ਸੰਗਮ ਵੀ ਮੇਰੇ ਵਿੱਚ ਆਪਣੇ ਤਾਂ ਪੂਰੀ ਪੂਰੀ ਰੂਚੀ ਨਾਲ ਭਰ ਦਿੱਤਾ ਹੈ ਇਸ ਮੌਕੇ 'ਤੇ ਬਾਈਕਿੰਗ ਨੇ ਮੇਰੇ ਆਤਮ ਸਮਰਨ ਅਤੇ ਨੇਚਰ ਦੇ ਸਾਥ ਹੋਣ ਦੇ ਮੌਕੇ ਵਿੱਚ ਵਿਕਸਿਤ ਹੋਈ ਆਤਮਿਕ ਬੈਲੰਸ ਦੇ ਨਾਲ ਨਾਲ ਮੇਰੀ ਜ਼ਿੰਦਗੀ ਨੂੰ ਵਿਰਾਟ ਰੂਪ ਵਿੱਚ ਸੰਤੁਲਨ ਕੀਤਾ ਗਿਆ ਹੈ ਮੈਂ ਬਾਈਕਿੰਗ ਬਾਈਕਿੰਗ ਦਾ ਕਰੀਅਰ ਚੂਜ ਕਰਕੇ ਬਹੁਤ ਖੁਸ਼ ਹਾਂ ਜਿਹਦੇ ਕਰਕੇ ਮੇਰੀ ਜ਼ਿੰਦਗੀ ਬਹੁਤ ਹੀ ਵਧੀਆ ਤਰੀਕੇ ਅਤੇ ਸਰਲ ਤਰੀਕੇ ਨਾਲ ਬੀਤ ਰਹੀ ਹੈ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਪ੍ਰੇਰਨਾ ਦਾ ਸਰੋਤ ਆਪਣੇ ਪਿਤਾ ਜੀ ਅਤੇ ਮੈਂ ਆਪਣੇ ਭਰਾ ਨੂੰ ਬਣਾਇਆ ਹੈ